ਹੈਲੋ ਹੈਲੋ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਹਾਂਜੀ ਭਾਜੀ ਅੱਛਾ ਅੱਛਾ ਅੱਛਾ ਭਾਜੀ

ਹਾਂਜੀ ਹਾਂਜੀ ਭਾਜੀ ਜ਼ਰੂਰ ਅਸੀਂ ਗਾਈਡ ਵੀ ਕਰਦੇ ਹਾਂ ਅਤੇ ਅਸੀਂ ਸਾਰੀਆਂ ਸੁੱਖ ਸਹੂਲਤਾਂ ਵੀ ਦਿੰਦੇ ਨੇ ਰਹਿਣ ਸਹਿਣ ਦਾ ਇੰਤਜ਼ਾਮ ਵੀ ਕਰ ਦਿੰਦੇ ਹਾਂ ਅਤੇ ਜਿਹੜੇ ਕਾਗਜ਼ ਪੱਤਰੀ ਕੰਮ ਹੁੰਦੇ ਅਸੀਂ ਉਹ ਵੀ ਕਰ ਦਿੰਦੇ ਹਾਂ

ਭਾਜੀ ਕੁੱਲ ਮਿਲਾ ਕੇ ਤੁਸੀਂ ਰੱਖ ਕੇ ਚੱਲੋ ਚਾਰ ਜਾਣੇ ਓ ਨਾ ਅਤੇ ਅਤੇ ਭਾਜੀ ਤੁਸੀਂ ਲਾ ਕੇ ਚੱਲੋ ਚਾਰ ਤਿੰਨ ਦਿਨ ਰਹਿਣਾ ਜੀ ਅੱਛਾ ਭਾਜੀ ਤਿੰਨ ਦਿਨ ਰਹਿਣਾ ਤੁਸੀਂ ਲਾ ਕੇ ਚੱਲੋ ਘੱਟੋ ਘੱਟ ਨਹੀਂ ਤਾਂ ਭਾਜੀ ਤੁਹਾਡਾ ਸੱਠ ਕੁ ਹਜ਼ਾਰ ਰੁਪਈਆ ਕੋਸਟ ਆ ਜਾਏਗਾ ਅਤੇ ਜਿਹਦੇ ਵਿੱਚ ਅਸੀਂ ਤੁਹਾਨੂੰ ਤੁਹਾਨੂੰ ਮੈਂ ਟੋਟਲ ਇੱਕ ਵਾਰੀ ਬਜਟ ਦੱਸ ਰਿਹਾਂ ਸਾਰਾ ਕਿ ਜਿਹਦੇ ਵਿੱਚ ਅਸੀਂ ਤੁਹਾਨੂੰ ਰਹਿਣ ਸਹਿਣ ਦਾ ਇੰਤਜ਼ਾਮ ਖਾਣ ਪੀਣ ਦਾ ਤਾਂ ਚਲੋ ਉੱਥੇ ਭਾਜੀ ਲੰਗਰ ਹੋਏਗਾ ਹੀ ਹੋਏਗਾ ਇੱਕ ਟਾਈਮ ਦਾ ਨਾ ਅਤੇ ਬਾਕੀ ਬਾਹਰ ਜੇ ਤੁਸੀਂ ਖਾਣਾ ਪੀਣਾ ਹੋਇਆ ਕੁਛ ਉਹ ਵੀ ਅਤੇ ਅਸੀਂ ਭਾਜੀ ਉੱਥੇ ਇੱਕ ਸਾਈਡ 'ਤੇ ਨਾ ਛੋਟੀ ਮਾਰਕੀਟ ਪੈਂਦੀ ਹੈ ਅਤੇ ਅਸੀਂ ਤੁਹਾਨੂੰ ਉਹਦੇ 'ਚ ਵੀ ਘੁਮਾਵਾਂਗੇ ਅਤੇ ਉੱਥੇ ਅਸੀਂ ਤੁਹਾਨੂੰ ਪਾਕਿਸਤਾਨ ਦੀ ਕਰੰਸੀ ਵੀ ਦਿਖਾਵਾਂਗੇ ਅਤੇ ਤੁਸੀਂ ਐਕਸਚੇਂਜ ਵੀ ਕਰ ਸਕਦੇ ਓਂ ਹਾਂਜੀ ਅਤੇ ਭਾਜੀ ਆਪਣਾ ਵਧੀਆ ਤੁਸੀਂ ਬਹੁਤ ਵਧੀਆ ਸੀਗਾ ਤੁਹਾਨੂੰ ਘੁੰਮਣ ਵਾਸਤੇ ਅਤੇ ਮੱਥਾ ਤੁਸੀਂ ਉੱਥੇ ਮੱਥਾ ਵੀ ਟੇਕ ਸਕਦੇ ਓ ਕਾਫ਼ੀ ਕੁਛ ਉੱਥੇ ਫੈਸਲਟੀਜ ਨੇ ਗੁਰੂ ਨਾਨਕ ਦੇਵ ਜੀ ਦਾ ਬਣਿਆ ਉੱਥੇ ਪਹਿਲਾ ਹੀ ਅਸਥਾਨ ਆਪਣੇ ਪਹਿਲੇ ਗੁਰੂ ਨੇ ਬਣਾਇਆ ਸੀ ਉੱਥੇ ਹੈ ਨਾ ਅਤੇ ਉੱਥੇ ਕਾਫ਼ੀ ਵਧੀਆ ਬਣਾਇਆ ਹੋਇਆ ਨੇ ਅਤੇ ਜਿਹੜੇ ਹੁਣ ਇਸ ਟੈਮ ਪਾਕਿਸਤਾਨ ਦੇ ਕਾਫ਼ੀ ਬੰਦੇ ਨੇ ਜਿਹੜੇ ਉੱਥੇ ਉਹ ਵੀ ਉੱਥੇ ਰੋਜ਼ਾਨਾ ਮੱਥਾ ਟੇਕਦੇ ਨੇ ਆ ਕੇ ਆਲੇ ਦੁਆਲੇ ਦੇ ਏਰੀਏ ਵਾਲੇ ਹਾਂਜੀ ਭਾਜੀ ਅਤੇ ਤੁਸੀਂ ਭਾਜੀ ਦੱਸ ਦੋ ਮੈਨੂੰ ਕਿਸ ਦਿਨ ਜਾਣਾ ਹੋਇਆ ਕਿਸ ਹਿਸਾਬ ਨਾਲ ਪ੍ਰੋਗਰਾਮ ਆ ਅਤੇ ਫਿਰ ਮੈਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਉਂਗਾ ਜੀ ਓਕੇ ਓਕੇ ਭਾਜੀ ਤੁਹਾਡੇ ਕੋਲ ਕੋਈ ਇੰਡੀਅਨ ਪਰੂਫ ਹੈਗੇ ਆ ਓਕੇ ਭਾਜੀ ਤੁਸੀਂ ਨਾ ਮੈਨੂੰ ਕੰਮ ਕਰਿਓ ਇੰਡੀਅਨ ਪਰੂਫ ਭੇਜ ਦਿਓ ਆਪਣੇ ਅਤੇ ਇੱਕ ਇੱਕ ਆਪਣੇ ਨਾ ਚਾਰਾਂ ਦੀ ਪਾਸਪੋਰਟ ਦੀ ਫੋਟੋ ਭੇਜ ਦਿਓ ਅਤੇ ਬਾਕੀ ਫਿਰ ਮੈਂ ਆਪਣਾ ਤੁਹਾਡੇ ਡੋਕੂਮੈਂਟ ਹੈਗੇ ਲਾ ਦਉਂਗਾ ਅਤੇ ਮੈਨੂੰ ਕੁਛ ਨਾ ਕੁਛ ਅਡਵਾਂਸ ਪੇਮੈਂਟ ਕਰ ਦਿਓ ਹਾਂਜੀ ਅੰਮ੍ਰਿਤਸਰ ਤੋਂ ਭਾਜੀ ਅਸੀਂ ਇੱਕ ਗੱਡੀ ਕੀਤੀ ਹਾਂਜੀ ਹਾਂਜੀ ਭਾਜੀ ਆਪਣੀ ਕਾਰ ਲੈ ਕੇ ਅਤੇ ਕਾਰ ਭੇਜਾਂਗੇ ਇਨੋਵਾ ਅਤੇ ਉਹ ਤੁਹਾਨੂੰ ਘਰੋਂ ਚੱਕੇਗੀ ਅਤੇ ਉੱਥੋਂ ਫਿਰ ਤੁਹਾਨੂੰ ਅੰਮ੍ਰਿਤਸਰ ਬੋਡਰ 'ਤੇ ਲੈ ਕੇ ਆਵੇਗੀ ਅਤੇ ਉੱਥੋਂ ਬੋਡਰ ਤੋਂ ਫਿਰ ਇੱਕ ਇੱਕ ਤੁਹਾਡੇ ਸਾਈਨ ਹੋਏਂਗੇ ਉੱਥੇ ਸਿਰਫ਼ ਹੋਰ ਕੁਛ ਨਹੀਂ ਕਰਨਾ ਅਤੇ ਤੁਹਾਨੂੰ ਇੱਕ ਕਾਰ 'ਚ ਬਿਠਾ ਕੇ ਫਿਰ ਤੁਹਾਨੂੰ ਬੋਡਰ ਪਾਰ ਕਰਾ ਕੇ ਫਿਰ ਤੁਹਾਨੂੰ ਉੱਥੇ ਲੈ ਜਾਣਗੇ ਅਤੇ ਉੱਥੇ ਫਿਰ ਤੁਸੀਂ ਆਪਣਾ ਦਰਸ਼ਨ ਕਰ ਲਿਓ ਦਰਸ਼ਨ ਕਰਕੇ ਆਪਣਾ ਲੰਗਰ ਪਾਣੀ ਛਕਿਓ ਅਤੇ ਫਿਰ ਉੱਥੇ ਬਾਅਦ ਫਿਰ ਤੁਹਾਨੂੰ ਅਸੀਂ ਸ਼ਾਮ ਨੂੰ ਮਾਰਕੀਟ ਘੁਮਾਵਾਂਗੇ ਅਤੇ ਉੱਥੇ ਹੀ ਹੋਟਲ ਹੈ ਉੱਥੇ ਹੀ ਨੇੜੇ ਹੀ ਹੋਟਲ ਹੈ ਬਿਲਕੁਲ ਗੁਰਦੁਆਰੇ ਦੇ ਅਤੇ ਜਿਹਦੇ ਨਾਲ ਤੁਹਾਨੂੰ ਗੁਰਦੁਆਰੇ ਦਾ ਵੀ ਵਧੀਆ ਵਿਊ ਮਿਲਦਾ ਰਹੇਗਾ ਹਾਂਜੀ ਭਾਜੀ ਅਤੇ ਬਾਕੀ ਭਾਜੀ ਤੁਸੀਂ ਮੈਨੂੰ ਕੋਈ ਨਹੀਂ ਮੈਨੂੰ ਡੋਕੂਮੈਂਟ ਭੇਜ ਦਿਓ ਜੀ ਹਾਂਜੀ ਭਾਜੀ ਓਕੇ ਭਾਜੀ ਵੈਲਕਮ ਓਕੇ